ਫਤਿਹਗੜ੍ਹ ਸਾਹਿਬ ਜਿੱਥੇ ਮੈਂ ਰਹਿ ਰਹੀ ਹਾਂ ਅਗਰ ਉੱਥੇ ਦੀ ਆਵਾਜਾਈ ਦੇ ਮੁੱਖ ਵਿਕਲਪ ਮੈਂ ਦੱਸਾਂ ਜਿਵੇਂ ਕਿ ਸੜਕਾਂ ਰੇਲਵੇ ਹਵਾਈ ਅੱਡੇ ਜਨਤਕ ਆਵਾਜਾਈ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਹੈ ਇਹ ਛੋਟਾ ਸ਼ਹਿਰ ਹੈ ਪਰ ਮੈਨੂੰ ਆਪਣਾ ਫਤਿਹਗੜ੍ਹ ਸਾਹਿਬ ਸ਼ਹਿਰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਕਿਉਂਕਿ ਇੱਥੇ ਛੋਟੇ ਸਾਹਿਬਜ਼ਾਦਾ ਜ਼ੋਰਾਵਰ ਫਤਿਹ ਸਿੰਘ ਬਾਬਾ ਫਤਿਹ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਆਪਣੀ ਸ਼ਹੀਦੀ ਪ੍ਰਾਪਤ ਕੀਤੀ ਅਤੇ ਉਹਨਾਂ ਦਾ ਜਨਮ ਵੀ ਇੱਥੇ ਹੀ ਹੋਇਆ ਅਤੇ ਉਹਨਾਂ ਦਾ ਹੀ ਉਹਨਾਂ ਦੇ ਨਾਮ ਦਾ ਹੀ ਇੱਕ ਕੋਲਜ ਮਾਤਾ ਗੁਜਰੀ ਕੋਲਜ ਜਿੱਥੇ ਮੈਂ ਪੜ੍ਹ ਰਹੀ ਹਾਂ ਮੈਨੂੰ ਬਹੁਤ ਮਾਣ ਹੈ ਵੀ ਮੈਂ ਫਤਿਹਗੜ੍ਹ ਸਾਹਿਬ ਵਿੱਚ ਰਹਿ ਰਹੀ ਹਾਂ ਅਗਰ ਸੜਕਾਂ ਦੀ ਗੱਲ ਕਰੀਏ ਸੜਕਾਂ ਵਿੱਚ ਸੀਵਰੇਜ ਸਾਰੀ ਜਗ੍ਹਾ ਪੈ ਚੁੱਕਾ ਹੈ ਅਤੇ ਕਾਫੀ ਬ੍ਰੈਂਡ ਇੱਥੇ ਖੁੱਲ੍ਹ ਚੁੱਕੇ ਹਨ ਜਿੱਥੇ ਕਾਫੀ ਲੋਕਾਂ ਨੂੰ ਮਦਦ ਮਿਲ ਸਕਦੀ ਹੈ ਅਗਰ ਬਾਗਾਂ ਦੀ ਗੱਲ ਕਰੀਏ ਘੁੰਮਣ ਵਾਸਤੇ ਉੱਥੇ ਆਮ ਖਾਸ ਬਾਗ ਵਗੈਰਾ ਸਭ ਕੁਛ ਇੱਥੇ ਮਿਲਦਾ ਈ ਰਿਕਸ਼ਾ ਬਸਿਸ ਸਭ ਕੁਛ ਇੱਥੇ ਮਿਲਦਾ ਜਿੱਥੇ ਵੀ ਕਿਸੇ ਨੇ ਜਾਣਾ ਹੋਵੇ ਸਾਰੀ ਆਵਾਜਾਈ ਬਹੁਤ ਵਧੀਆ ਹੈ